ਸਰਕਾਰ ਜੋ ਹੈ ਆਪਣੇ ਉਦਯੋਗਾਂ ਨੂੰ ਫੈਲਾਉਣ ਵਾਸਤੇ ਕਈ ਪ੍ਰਕਾਰ ਦੀ ਮਦਦ ਕਰ ਰਹੀ ਹੈ ਜਿਵੇਂ ਕਿ ਛੋਟੇ ਉਦਯੋਗਾਂ ਨੂੰ ਘੱਟ ਦਰਾਂ ਦੇ ਉੱਤੇ ਬਿਜਲੀ ਮੁਹੱਈਆ ਕਰਵਾ ਰਹੀ ਹੈ ਬਿਜਲੀ ਕਰਕੇ ਉਹਨਾਂ ਨੂੰ ਬਿਲ ਘੱਟ ਆਉਂਦਾ ਹੈ ਜਿਸ ਨਾਲ ਉਹਨਾਂ ਨੂੰ ਹੋਰ ਬਚ ਕੇ ਪੈਸਾ ਕਿਤੇ ਹੋਰ ਲਾ ਲੈਂਦੇ ਹਨ ਸਰਕਾਰ ਆਪਣੀ ਖੇਤੀਬਾੜੀ ਲਈ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਦੇ ਰਹੀ ਹੈ ਜਿਵੇਂ ਕਿ ਉੱਥੇ ਫਰੀ ਬਿਜਲੀ ਉਹਨਾਂ ਨੂੰ ਯੂਰੀਆ ਪ੍ਰੋਵਾਈਡ ਕਰਵਾ ਰਹੀ ਹੈ ਜਿਸ ਨਾਲ ਜਿਹੜੇ ਹੀ ਕਿ ਖੇਤੀਬਾੜੀ ਬਹੁਤ ਈਜ਼ੀ ਹੋ ਗਈ ਹੈ ਉਹਨਾਂ ਦੀ ਫਸਲ ਦੀ ਪੈਦਾਵਾਰ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਿੱਧਾ ਕਿਸਾਨ ਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਦੂਸਰਾ ਜੋ ਹੈ ਕਿ ਆਪਣਾ ਵੂਲਨ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਸਰਕਾਰ ਕਈ ਤਰ੍ਹਾਂ ਦੀਆਂ ਐਗਜੀਬਿਸ਼ਨਾਂ ਕਈ ਤਰ੍ਹਾਂ ਦੇ ਪ੍ਰਮੋਸ਼ਨ ਐਡਵੋਰਟਾਈਜਮੈਂਟ ਅਤੇ ਆਦਿ ਕਰਕੇ ਆਪਣੀ ਵੂਲਨ ਇੰਡਸਟਰੀ ਨੂੰ ਫੈਲਾਉਣ ਦੀ ਹਰ ਸੰਭਵ ਪਰਿਆਸ ਕਰ ਰਿਹਾ ਹੈ ਤਾਂ ਕਿ ਸਾਡੇ ਪੰਜਾਬ ਦਾ ਨਾਮ ਉੱਚੇ ਪੱਧਰ 'ਤੇ ਪਹੁੰਚੇ ਅਤੇ ਕਿਸੇ ਨੂੰ ਵੀ ਇੱਥੇ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਹਰ ਤਰ੍ਹਾਂ ਦੀ ਖੁਸ਼ਹਾਲੀ ਰਹੇ ਇੱਥੇ ਬਹੁਤ ਵਧੀਆ ਕੰਮ ਕਰਕੇ ਸਰਕਾਰ ਦਿਖਾ ਰਹੀ ਹੈ ਜਿਸ ਦਾ ਲਾਭ ਸਾਰੇ ਪੰਜਾਬ ਦੇ ਵਾਸੀਆਂ ਨੂੰ ਮਿਲ ਰਿਹਾ ਹੈ